ਮੈਂ ਸਿੱਖ ਧਰਮ ਦੇ ਨਾਲ ਮਤਲਬ ਸਬੰਧ ਰੱਖਦਾ ਹਾਂ ਸਿੱਖ ਇਤਿਹਾਸ ਮਹੱਤਵਪੂਰਨ ਇਤਿਹਾਸਿਕ ਘਟਨਾਵਾਂ ਦਾ ਇੱਕ ਖਜ਼ਾਨਾ ਜਿਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਘਟਨਾਵਾਂ ਸਾਕੇ ਜਿਹੜੇ ਨੇ ਕਿ ਉਹ ਵਾਪਰੇ ਨੇ ਅਤੇ ਜੋ ਸਿੱਖ ਇਤਿਹਾਸ ਹੈ ਉਹ ਇਹਨਾਂ ਘਟਨਾਵਾਂ ਦੇ ਨਾਲ ਭਰਿਆ ਪਿਆ ਜਿਵੇਂ ਕਿ ਬਹੁਤ ਸਾਰੀਆਂ ਘਟਨਾਵਾਂ ਮੈਂ ਗਿਣਤੀ ਨਹੀਂ ਦੱਸ ਸਕਦਾ ਸਭ ਤੋਂ ਵੱਡੀ ਮੇਰੇ ਹਿਸਾਬ ਨਾਲ ਘਟਨਾ ਵਾਪਰੀ ਹੈ ਜੋ ਮਤਲਬ ਬਹੁਤ ਸ਼ਹੀਦੀਆਂ ਵੀ ਹੋਈਆਂ ਨੇ ਪਰ ਇੱਕ ਅਹਿਮ ਘਟਨਾ ਜੋ ਕਿ ਸੋਲ੍ਹਾਂ ਸੌ ਨੜਿਨਵੇਂ ਈਸਵੀ ਦੇ ਵਿੱਚ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਖਾਲਸਾ ਪੰਥ ਦੀ ਸਥਾਪਨਾ ਕੀਤੀ ਹੈ ਉਹ ਬਹੁਤ ਹੀ ਮਹੱਤਵਪੂਰਨ ਘਟਨਾ ਹੈ ਜਿਸ ਦੇ ਨਾਲ ਗੁਰੂ ਜੀ ਨੇ ਲੋਕਾਂ ਨੂੰ ਜ਼ੁਲਮ ਦਾ ਜਿਹੜਾ ਟਾਕਰਾ ਕਰਨ ਦੇ ਲਈ ਇੱਕ ਫੌਜ ਤਿਆਰ ਕੀਤੀ ਜੋ ਕਿ ਜੋ ਮਜਲੂਮਾਂ ਦੇ ਉੱਪਰ ਜ਼ੁਲਮ ਹੋ ਰਹੇ ਸੀਗੇ ਉਹਨਾਂ ਨੂੰ ਠੱਲ ਪਾਉਣ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਸੀ ਜਿਸ ਦੇ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁ ਦੇ ਬਹੁਤ ਹੀ ਅਸੀਂ ਰਿਣੀ ਹਾਂ ਉਹਨਾਂ ਨੇ ਸੋਲ੍ਹਾਂ ਸੌ ਨੜਿਨਵੇਂ ਈਸਵੀ ਦੇ ਵਿੱਚ ਸਿੱਖ ਪੰਥ ਨੂੰ ਇੱਕ ਨਵਾਂ ਰੂਪ ਦਿੱਤਾ

ਤਾਂ ਉਹ ਜੋ ਉਹਨਾਂ ਦੇ ਪੈਰੋਕਾਰ ਸੀਗੇ ਅਤੇ ਉਹਨਾਂ ਦੇ ਵਿੱਚੋਂ ਪੰਜ ਜਿਹੜੇ ਸਿੰਘ ਸੀਗੇ ਸਿੱਖ ਸੀਗੇ ਮਤਲਬ ਉਸ ਸਮੇਂ ਤਾਂ ਉਹ ਉਹਨਾਂ ਨੇ ਆਪਣੀ ਜਾਨ ਕੁਰਬਾਨ ਕਰਨ ਦੇ ਲਈ ਗੁਰੂ ਜੀ ਦੇ ਸਾਹਮਣੇ ਆ ਗਏ ਸੀਗੇ ਤੋ ਬਹੁਤ ਹੀ ਘਟਨਾਵਾਂ ਨੇ ਗੀਆਂ ਜਿਵੇਂ ਕਿ ਚਮਕੌਰ ਦੀ ਜੰਗ ਵੀ ਇੱਕ ਬਹੁਤ ਮਹੱਤਵਪੂਰਨ ਘਟਨਾ ਗੀ ਜਿ ਜਿਸ ਦੇ ਨਾਲ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਸੀਗਾ ਅਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਨੇਗੀਆਂ ਜਿਵੇਂ ਗੁਰੂ ਨਾਨਕ ਦੇਵ ਜੀ ਤੋਂ ਜੇ ਜਨਮ ਜੀ ਤੋਂ ਲੈ ਕੇ ਮਤਲਬ ਅੱਜ ਤੱਕ ਵੀ ਸਿੱਖਾਂ ਦੇ ਨਾਲ ਸਿੱਖਾਂ ਦੇ ਨਾਲ ਘਟਨਾਵਾਂ ਵਾਪਰਦੀਆਂ ਰਹੀਆਂ ਨੇ ਗੀਆਂ ਨੀਲਾ ਤਾਰਾ ਉੱਨੀ ਸੌ ਚੁਰਾਸੀ ਦਾ ਜਿਹੜਾ ਕਿ ਦੁਖਾਂਤ ਸੀ ਉਹ ਵੀ ਇੱਕ ਬਹੁਤ ਮੰਦਭਾਗੀ ਘਟਨਾ ਸੀਗੀ ਉਹ ਸਿੱਖ ਇਤਿਹਾਸ ਘਟਨਾਵਾਂ ਦਾ ਇੱਕੋ ਇੱਕ ਖਜ਼ਾਨਾ ਗਾ